ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਮਹਿਕ ਬਾਤ ਕਰ ਰਹੀ ਹੂੰ ਤੁਸੀਂ ਕੌਣ ਜੀ ਮੈਂ ਤੁਹਾਨੂੰ ਪੁੱਛਣਾ ਸੀ ਤੁਸੀਂ ਕਦੀ ਵੀ ਕੋਈ ਵੀ ਬੋਲੀਵੁੱਡ ਜਾਂ ਪੰਜਾਬੀ ਮੂਵੀ ਦੀ ਸ਼ੂਟਿੰਗ ਹੁੰਦੀਆਂ ਹੋਏ ਦੇਖੀਆਂ ਤੁਸੀਂ ਕਦੀ ਹਾਂਜੀ ਹਾਂਜੀ ਅਸੀਂ ਗਏ ਸੀਗੇ ਇੱਕ ਵਾਰੀ ਹੋਈ ਸੀਗੀ ਸ਼ੂਟਿੰਗ ਫਿਲਮ ਦੀ ਤਾਂ ਉੱਥੇ ਜਿਹੜੇ ਐਕਟਰਸ ਆਏ ਹੋਏ ਸੀ ਪੰਜਾਬੀ ਉਨ੍ਹਾਂ ਦਾ ਐਟੀਟਿਊਡ ਲੈਵਲ ਇੰਨਾ ਸੀਗਾ ਈਵਨ ਕਿ ਜਿਹੜੇ ਉਨ੍ਹਾਂ ਦੇ ਫੈਨ ਆ ਰਹੇ ਸੀ ਕਾਫੀ ਫੈਨ ਆਏ ਉਨ੍ਹਾਂ ਦੇ ਉਨ੍ਹਾਂ ਨੇ ਉਨ੍ਹਾਂ ਨੂੰ ਵੀ ਸਹੀ ਤਰੀਕੇ ਨਾਲ ਨਹੀਂ ਬੁਲਾਇਆ ਉਨ੍ਹਾਂ ਨੂੰ ਧੱਕੇ ਨਾਲ ਪਿੱਛੇ ਕਰ ਰਹੇ ਸੀ ਜਿਹੜੇ ਉਨ੍ਹਾਂ ਦੇ ਬੋਡੀਗਾਡ ਸੀ ਉਨ੍ਹਾਂ ਦਾ ਵੀ ਐਟੀਟਿਊਡ ਲੈਵਲ ਤਾਂ ਬਹੁਤ ਹਾਈ ਸੀਗਾ ਮੈਨੂੰ ਲੱਗਦਾ ਨਹੀਂ ਹੈ ਕਿ ਜਿਹੜੇ ਐਕਟਰ ਹੁੰਦੇ ਉਨ੍ਹਾਂ ਨੂੰ ਇੰਨਾ ਹਾਈ ਐਟੀਟਿਊਡ ਲੈਵਲ ਰੱਖਣਾ ਚਾਹੀਦਾ ਤੁਹਾਡੇ ਕੀ ਵਿਚਾਰ ਹੈ ਇਸ ਬਾਰੇ ਹਾਂਜੀ ਹਾਂਜੀ ਕਈ ਹਾਂਜੀ ਕਈ ਪੰਜਾਬੀ ਐਕਟਰਸ ਇੱਦਾਂ ਨੇ ਜੋ ਬਹੁਤ ਹੀ ਡਾਊਨ ਟੂ ਅਰਥ ਨੇ ਪਰ ਅਗਰ ਉਨ੍ਹਾਂ ਦੇ ਓਪੋਜਿਟ ਜਾਈਏ ਤਾਂ ਕਈ ਇਸ ਤਰ੍ਹਾਂ ਦੇ ਨੇ ਜਿਹੜੇ ਦੇਖ ਕੇ ਆਪਣਾ ਫੇਸ ਟਰਨ ਕਰ ਲੈਂਦੇ ਨੇ ਦੇਖਦੇ ਤੱਕ ਵੀ ਨਹੀਂ ਹੈ ਹਾਂਜੀ ਪਰ ਉਨ੍ਹਾਂ ਨੂੰ ਇਹ ਵੀ ਸੋਚਣਾ ਚਾਹੀਦਾ ਨਾ ਕਿ ਅੱਜ ਉਹ ਸੈਲੀਬ੍ਰੀਟੀ ਬਣੇ ਨੇ ਤਾਂ ਪਬਲਿਕ ਦੇ ਕਾਰਨ ਬਣੇ ਨੇ ਅਗਰ ਪਬਲਿਕ ਨਹੀਂ ਤਾਂ ਉਹ ਸਭ ਕੁਛ ਵੀ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਅਗਰ ਉਨ੍ਹਾਂ ਦਾ ਐਟੀਟਿਊਡ ਇੰਨਾ ਹੈ ਤਾਂ ਕਰਕੇ ਹੈ ਕਿਉਂਕਿ ਉਨ੍ਹਾਂ ਕੋਲ ਕਾਫੀ ਪੈਸਾ ਹੈ ਤਾਂ ਉਨ੍ਹਾਂ ਨੂੰ ਸਾਡੇ ਜਿਹੜੇ ਪਬਲਿਕ ਹੈ ਖ਼ੁਦ ਪਬਲਿਕ ਉਨ੍ਹਾਂ ਨੂੰ ਕਾਫੀ ਜ਼ਿਆਦਾ ਹਾਈ ਬਣਾ ਦਿੰਦੀ ਆ ਅਤੇ ਜਿਸ ਕਰਕੇ ਉਨ੍ਹਾਂ ਦਾ ਐਟੀਟਿਊਡ ਬਹੁਤ ਜ਼ਿਆਦਾ ਵੱਧ ਜਾਂਦਾ ਕਿਸੇ ਇੱਕ ਪਰਸਨ ਨੂੰ ਪਬਲਿਕ ਜ਼ਿਆਦਾ ਐਪਰੀਸ਼ੀਏਟ ਕਰ ਦਿੰਦੀ ਆ ਤਾਂ ਉਹ ਫਿਰ ਜ਼ਿਆਦਾ ਉਹਦੇ 'ਚ ਈਗੋ ਆ ਜਾਂਦੀ ਹੈ ਹਾਂ ਬੀ ਹਾਂ ਮੈਂ ਹੈ ਤਾਂ ਮੈਂ ਹੀ ਹਾਂ ਹਾਂਜੀ ਮੈਂ ਬਸ ਹਾਂਜੀ ਹਾਂਜੀ ਪਰ ਉਨ੍ਹਾਂ ਨੂੰ ਮੈਨੂੰ ਲੱਗਦਾ ਹੈ ਕਿ ਡਾਊਨ ਟੂ ਅਰਥ ਰਹਿ ਕੇ ਹਰ ਇੱਕ ਕੰਮ ਕਰਨਾ ਚਾਹੀਦਾ ਅਗਰ ਫੈਂਨਸ ਨੇ ਤਾਂ ਸੈਲੀਬ੍ਰੀਟੀ ਨੇ ਅਗਰ ਫੈਨਸ ਨਹੀਂ ਤਾਂ ਸੈਲੀਬ੍ਰੀਟੀ ਵੀ ਨਹੀਂ ਹੈ ਤਾਂ ਹਾਂਜੀ ਹਾਂਜੀ ਅੱਜ ਮੇਰਾ ਦਿਲ ਕਰ ਰਿਹਾ ਸੀ ਤੁਹਾਨੂੰ ਇਸ ਟੋਪਿਕ 'ਤੇ ਇਸ ਬਾਰੇ ਕੁਛ ਪੁੱਛਾਂ ਅਤੇ ਮੈਂ ਇਸ ਲਈ ਤੁਹਾਨੂੰ ਕੋਲ ਕੀਤਾ ਥੈਂਕਯੂ ਤੁਸੀਂ ਮੇਰਾ ਕੋਲ ਰਸੀਵ ਕੀਤਾ ਸਤਿ ਸ਼੍ਰੀ ਅਕਾਲ